ਅੱਜ ਕੱਲ੍ਹ ਦੇ ਸਮੇਂ ਵਿੱਚ ਅਸੀਂ ਪੰਜਾਬੀ ਭਾਸ਼ਾ ਦੀ ਵਰਤੋਂ ਘੱਟ ਕਰਦੇ ਹਾਂ ਦੂਜੀਆਂ ਭਸ਼ਾਵਾਂ ਦੀ ਜ਼ਿਆਦਾ ਵਰਤੋਂ ਕਰਦੇ ਐ ਇਸ ਨਾਲ ਤਾਂ ਜੋ ਸੱਭਿਆਚਾਰ 'ਤੇ ਬਹੁਤ ਹੀ ਅੱਛਾ ਪ੍ਰਭਾਵ ਨਹੀਂ ਹੈ ਮਤਲਬ ਨਕਾਰਿਆ ਜਾ ਰਿਹਾ ਪੰਜਾਬੀ ਭਾਸ਼ਾ ਨੂੰ ਅਸੀਂ ਅੱਜ ਕੱਲ੍ਹ ਜਿਵੇਂ ਕਿ ਰੋਜ਼ਾਨਾ ਜੀਵਨ ਵਿੱਚ ਅਸੀਂ ਕਿਸੇ ਨੂੰ ਵੀ ਸਤਿ ਸ਼੍ਰੀ ਅਕਾਲ ਦੀ ਥਾਂ 'ਤੇ ਗੁੱਡ ਮੋਰਨਿੰਗ ਹੀ ਬੋਲਦੇ ਹੈਗੇ ਇਸ ਨਾਲ ਸਾਡੇ ਸਭ ਸੱਭਿਆਚਾਰ ਹੈ ਜੋ ਕਿ ਨਕਾਰਿਆ ਜਾ ਰਿਹਾ ਇਸ ਨਾਲ ਪੰਜਾਬੀ ਭਾਸ਼ਾ ਵੀ ਜਿਹੜੀ ਦੁਰਵਰਤੋਂ ਕੀਤੀ ਜਾਂਦੀ ਹੈ ਮਤਲਬ ਅਸੀਂ ਉਸ ਦੀ ਵਰਤੋਂ ਤਾਂ ਕਰਦੇ ਹੈਗੇ ਵੋ ਉਹ ਵੀ ਕੋਈ ਕੋਈ ਸ਼ਬਦਾਂ ਭਾਸ਼ਾਵਾਂ ਵਿੱਚੋ ਬੋਲਿਆ ਜਾਂਦਾ ਇਸ ਨਾਲ ਫਿਰ ਪੰਜਾਬੀ ਭਾਸ਼ਾ ਨੂੰ ਨਕਾਰਿਆ ਜਾ ਰਿਹਾ ਇਸ ਲਈ ਸਾਨੂੰ ਆਪ ਦੇ ਸੱਭਿਆਚਾਰ ਦੀ ਜਾਣਕਾਰੀ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਸੱਭਿਆਚਾਰ ਬਹੁਤ ਵਧੀਆ ਬਣਿਆ ਰਹੇ ਤਾਂ ਜੋ ਪੰਜਾਬੀ ਸੱਭਿਆਚਾਰ ਤੌਰ 'ਤੇ ਵਰਤਿਆ ਜਾਵੇ ਇਸ ਨਾਲ ਪੰਜਾਬੀ ਸੱਭਿਆਚਾਰ ਸਾਡਾ ਬਹੁਤ ਹੀ ਵਧੀਆ ਅਤੇ ਪੰਜਾਬੀ ਭਾਸ਼ਾ ਨੂੰ ਆਮ ਜ਼ਿੰਦਗੀ ਵਿੱਚ ਵਰਤਿਆ ਜਾ ਸਕੇਗਾ ਆ ਕੋਈ ਹੁੰਦੇ ਹੈਗੇ ਜੋ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਘੱਟ ਕਰਦੇ ਹੈ ਦੂਜੀਆਂ ਭਾਸ਼ਾਵਾਂ ਨੂੰ ਹੀ ਆਪਣੇ ਜੀਵਨ ਵਿੱਚ ਮਹੱਤਵਪੂਰਨ ਕਰ ਰੱਖਿਆ ਜਿਵੇਂ ਕਿ ਬਾਏ ਕਿਸੇ ਨੂੰ ਬੋਲ ਲਿਆ ਜਾਂ ਕਿਸੇ ਨੂੰ ਗੁੱਡ ਮੋਰਨਿੰਗ ਗੁੱਡ ਆਫਟਰਨੂਨ ਇੱਦਾਂ ਦੀ ਰੂਟੀਨ ਬਣਾ ਰੱਖੇ ਨੇ ਇਸ ਨਾਲ ਪੰਜਾਬੀ ਸੱਭਿਆਚਾਰ 'ਤੇ ਬੁਰਾ ਪ੍ਰਭਾਵ ਅਤੇ ਨਕਾਰਾਤਮਕ ਕਿ ਭਾਸ਼ਾਵਾਂ ਦਾ ਪ੍ਰਭਾਵ ਹੋ ਰਿਹਾ